ਮੇਰੇ ਜਾਣਕਾਰ ਵਿੱਚ ਇੱਕ ਲੜਕਾ ਹੈ ਸੀ ਜਿਸ ਨੇ ਮਤਲਬ ਜਿਸ ਨੂੰ ਪੜ੍ਹਨ ਦਾ ਬੜਾ ਸ਼ੌਂਕ ਸੀ ਅਤੇ ਉਹ ਮੇਰੇ ਕੋਲ ਟਿਊਸ਼ਨ ਪੜ੍ਹਨ ਲਈ ਆਉਂਦਾ ਸੀ ਪਰ ਉਸਦੇ ਪਾਪਾ ਕੋਲ ਟਿਊਸ਼ਨ ਦੀ ਫੀਸ ਦੇਣ ਦੇ ਪੈਸੇ ਨਹੀਂ ਸੀ ਹੁੰਦੇ ਅਤੇ ਮੈਂ ਉਸਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਪੈਸੇ ਨਾ ਦੇਈ ਤੂੰ ਮੇਰੇ ਕੋਲ ਪੜ੍ਹਦਾ ਰਹਿ ਮੈਂ ਉਸਦੀ ਲਗਨ ਦੇਖ ਕੇ ਉਹਦੇ ਤੋਂ ਬੜੀ ਪ੍ਰਭਾਵਿਤ ਸੀ ਉਹ ਬੱਚਾ ਪੜ੍ਹਦਾ ਰਿਹਾ ਅਤੇ ਮੈਨੂੰ ਇੱਕ ਦਿਨ ਪੁੱਛਣ ਲੱਗਿਆ ਕਿ ਮੈਂ ਹੁਣ ਕੀ ਲੈਣਾ ਚਾਹੀਦਾ ਹੈ ਮੈਂ ਕਿਹਾ ਤੇਰਾ ਮੈਥਸ ਬਹੁਤ ਅੱਛਾ ਤੂੰ ਇਹਦੇ 'ਚ ਪੜ੍ਹ ਲੈ ਅਤੇ ਸੀ ਏ ਵਾਲੀ ਲਾਈਨ 'ਚ ਚਲਾ ਜਾਈ ਤਾਂ ਉਹ ਬੱਚਾ ਜਿਹੜਾ ਸੀ ਉਹਨੂੰ ਇਹ ਗੱਲ ਦਿਮਾਗ 'ਚ ਬੈਠ ਗਈ ਅਤੇ ਉਹ ਬੱਚਾ ਪੜ੍ਹਾਈ ਦਿਨ ਰਾਤ ਕਰਨ ਲੱਗ ਗਿਆ ਕਿਸੇ ਟਿਊਸ਼ਨ 'ਤੇ ਨਹੀਂ ਸੈਂਟਰ 'ਚ ਨਹੀਂ ਗਿਆ ਕੁਛ ਨਹੀਂ ਉਹਨੇ ਆਪਣੇ ਘਰ ਬੈਠ ਕੇ ਪੜ੍ਹਾਈ ਕੀਤੀ ਅਤੇ ਬਹੁਤ ਜਲਦੀ ਹੀ ਉਹ ਆਪਣੀ ਸੀ ਏ ਕੰਪਲੀਟ ਕਰ ਗਿਆ ਸੀ ਏ ਕੰਪਲੀਟ ਕਰਕੇ ਅਤੇ ਉਹਨੇ ਆਪਣੇ ਘਰ ਦਾ ਪੂਰਾ ਬੀੜਾ ਚੁੱਕ ਲਿਆ ਆਪਣੇ ਪਾਪਾ ਨੂੰ ਕੰਮ ਨਹੀਂ ਕਰਨ ਦਿੱਤਾ ਅਤੇ ਪੂਰੇ ਇਲਾਕੇ ਦੇ ਵਿੱਚ ਉਹਨੇ ਆਪਣੀ ਨਾਮ ਰੋਸ਼ਨ ਆਪਣੇ ਪਾਪਾ ਦਾ ਕੀਤਾ ਪੂਰੀ ਟੌਹਰ ਬਣੀ ਉਹਦੀ ਇਸ ਟਾਈਮ ਉਹ ਮਤਲਬ ਲੁਧਿਆਣੇ ਦੇ ਵਿੱਚ ਇੱਕ ਬੜੇ ਪੋਸ਼ ਏਰੀਆ ਦੇ ਵਿੱਚ ਉਹਨੇ ਬਹੁਤ ਵੱਡੀ ਕੋਠੀ ਬਣਾਈ ਹੈ ਆਪਣੇ ਪੂਰੇ ਪਰਿਵਾਰ ਦਾ ਉਹਦੇ ਨੇ ਨਾਮ ਰੋਸ਼ਨ ਕੀਤਾ ਹੈ ਅਤੇ ਮੈਨੂੰ ਮਤਲਬ ਇਹ ਮੈਨੂੰ ਦੇਖ ਕੇ ਬੜਾ ਪ੍ਰਾਊਡ ਫੀਲ ਹੁੰਦਾ ਹੈ ਮੇਰੀ ਬਹੁਤ ਇੱਜ ਅਜੇ ਤੱਕ ਇੱਜਤ ਕਰਦਾ ਮੇਰੇ ਹਿਸਾਬ ਨਾਲ ਉਹਨੇ ਬਹੁਤ ਚੰਗਾ ਕੀਤਾ ਹੈ